ਭੰਗੜਾ ਐਰੋਬਿਕਸ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਣ ਵਾਲਾ ਇੱਕ ਲੋਕ ਨਾਚ ਹੈ ਇਹ ਖੁਸ਼ੀ ਦੇ ਪ੍ਰਗਟਾਵੇ ਦੀ ਨਿਸ਼ਾਨੀ ਹੈ ਪਰ ਕਈ ਲੋਕ ਸੋਚਦੇ ਹਨ ਕਿ ਇਹ ਇੱਕ ਚੀਖ ਚਿਹਾੜਾ ਹੈ ਜਿਸ ਵਿੱਚ ਢੋਲ ਦਾ ਸ਼ੋਰ ਸ਼ਰਾਬਾ ਅਤੇ ਭੰਗੜਾ ਪਾਉਣ ਵਾਲਿਆਂ ਦੀਆਂ ਉੱਚੀਆਂ ਉੱਚੀਆਂ ਚੀਕਾਂ ਲੋਕਾਂ ਨੂੰ ਦਿਮਾਗੀ ਪ੍ਰੇਸ਼ਾਨੀਆਂ ਦਿੰਦੀਆਂ ਹਨ ਉਹ ਉਸ ਨੂੰ ਬਾਂਦਰਾਂ ਵਾਂਗ ਟੱਪਣਾ ਹੀ ਆਖਦੇ ਹਨ ਪਰ ਅਸਲ ਵਿੱਚ ਇਹ ਬਹੁਤ ਵਧੀਆ ਕਸਰਤ ਵੀ ਹੈ ਜਿਸ ਵਿੱਚ ਸਰੀਰ ਦਾ ਇੱਕ ਇੱਕ ਹਿੱਸਾ ਹਿੱਲਦਾ ਹੈ ਅਤੇ ਚੀਖ ਚਿਹਾੜਾ ਨਾ ਹੋ ਕੇ ਇਹ ਆਪਣੇ ਹਰ ਰੋਜ਼ ਦੇ ਕੰਮਕਾਰ ਅਤੇ ਚਿੰਤਾਵਾਂ ਨੂੰ ਦੂਰ ਕਰਦਾ ਹੈ ਭੰਗੜਾ ਸਾਡੇ ਦਿਮਾਗ ਨੂੰ ਵੀ ਤੰਦਰੁਸਤ ਰੱਖਦਾ ਹੈ ਅਤੇ ਸਾਰੇ ਸਰੀਰ ਨੂੰ ਚੁਸਤ ਫੁਰਤ ਅਤੇ ਫੁਰਤੀਲਾ ਬਣਾਉਂਦਾ ਹੈ ਸਾਨੂੰ ਆਪਣੇ ਪੰਜਾਬੀ ਸੱਭਿਆਚਾਰ ਬਾਰੇ ਲੋਕਾਂ ਵਿੱਚ ਵੱਧ ਤੋਂ ਵੱਧ ਫੈਲਾਅ ਕਰਨ ਦੀ ਲੋੜ ਹੈ ਤਾਂ ਜੋ ਉਹ ਭੰਗੜੇ ਦੇ ਮਤਲਬ ਨੂੰ ਸਹੀ ਤਰੀਕੇ ਨਾਲ ਸਮਝ ਸਕਣ